ਭਾਰਤ ਵਿੱਚ ਬਹੁਤ ਸਾਰੇ ਵਪਾਰੀ ਉਦਯੋਗਪਤੀ ਅਤੇ ਨੇਤਾ ਹਨ ਜਿਹਨਾਂ ਨੇ ਭਾਰਤ ਨੂੰ ਕਈ ਤਰੀਕਿਆਂ ਨਾਲ ਬਦਲਿਆ ਹੈ ਜਿਵੇਂ ਕਿ ਟੈਕਨੋਲੋਜੀ ਸਿੱਖਿਆ ਮਨੋਰੰਜਨ ਵਪਾਰ ਅਤੇ ਆਵਾਜਾਈ ਇਹਨਾਂ ਵਿੱਚੋਂ ਇੱਕ ਮਿਸਟਰ ਭਗਵੰਤ ਮਾਨ ਹਨ ਜਿਹਨਾਂ ਨੇ ਬੁਹਤ ਸਾਰੇ ਸਿੱਖਿਆ ਵਿਭਾਗ ਬਣਾਏ ਬੱਚਿਆਂ ਨੂੰ ਮੁਫਤ ਸਿੱਖਿਆ ਵਜ਼ੀਫੇ ਹਰ ਤਰ੍ਹਾਂ ਨਾਲ ਉਹਨਾਂ ਦੀ ਉਹਨਾਂ ਦੇ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕੀਤੀ ਹੈ ਉਹਨਾਂ ਨੇ ਕਈ ਸੜਕਾਂ ਬਣਾਈਆਂ ਕਈ ਕੁਛ ਬਹੁਤ ਸਾਰੇ ਹਸਪਤਾਲ ਅਨਇੰਪਲਾਇਮੈਂਟ ਜਿਵੇਂ ਕਿ ਬੇਰੁਜ਼ਗਾਰ ਬੰਦਿਆਂ ਨੂੰ ਨੌਕਰੀਆਂ ਪੇਸ਼ੇ ਸਭ ਕੁਛ ਦਿੱਤਾ ਉਹਨਾਂ ਨੇ ਇਹਨਾਂ ਨੇ ਆਪਣੇ ਉਹ ਟੈਕਨੋਲੋਜੀ ਹਸਪਤਾਲ ਡੋਕਟਰੀ ਸਹਾਇਤਾ ਵਜ਼ੀਫੇ ਬੱਚਿਆਂ ਨੂੰ ਬਹੁਤ ਕੁਛ ਦਿੱਤਾ ਹੈ ਇਹਨਾਂ ਇਹਨਾਂ ਦਾ ਬਹੁਤ ਸਾਰਾ ਹੀ ਇਹਦੇ ਵਿੱਚ ਉਹਨਾਂ ਦਾ ਹੱਥ ਹੈ ਬਹੁਤ ਸਾਰੇ ਬੰਦ ਜਿਹੜੇ ਦੁਨੀਆ ਦੇ ਲੋਕ ਇਹਨਾਂ ਨੂੰ ਇਹਨਾਂ 'ਤੇ ਬਹੁਤ ਮਾਣ ਰੱਖਦੇ ਹਨ ਮਾਣ ਕਰਦੇ ਹਨ ਉਹਨਾਂ ਨੇ ਬਹੁਤ ਕੁਛ ਦੁਨੀਆ ਦੇ ਵਿੱਚ ਬਹੁਤ ਕੁਛ ਬਦਲਿਆ ਹੈ ਬਹੁਤ ਕੁਛ ਬਦਲਿਆ ਹੈ ਗਰੀਬ ਲੋਕਾਂ ਨੂੰ ਰੁਜ਼ਗਾਰ ਦਿੱਤੇ ਹਨ ਉਹਨਾਂ ਦੀ ਮਾਲੀ ਸਹਾਇਤਾ ਉਹਨਾਂ ਨੂੰ ਪੈਸੇ ਦੇ ਨਾਲ ਉਹਨਾਂ ਨੂੰ ਬੜਾ ਕੁਛ ਮਾਣ ਦਿੱਤਾ ਹੈ ਪੈਸੇ ਨਾਲ ਇਸ ਇਹ ਇਹਨਾਂ ਦਾ ਇਹਨਾਂ ਦੇ ਹੱਥਾਂ ਸਿੱਖਿਆ ਵਿਭਾਗ ਅਤੇ ਨਿੱਕੀ ਵਿਭਾ ਹਸਪਤਾਲ ਡਾਕਟਰੀ ਸਹਾਇਤਾ ਸੜਕਾਂ ਆਵਾਜਾਈ ਦੇ ਸਾਧਨ ਉਹ ਦਿੱਤੇ ਹਨ ਜਿਵੇਂ ਕਿ ਔਰਤਾਂ ਨੂੰ ਬੱਸਾਂ ਦੇ ਵਿੱਚ ਮੁਫਤ ਆਉਣ ਜਾਣ ਦੀ ਸਹਾਇਤਾ ਦਿੱਤੀ ਹੈ ਇਸ ਨੂੰ ਇਸ ਲਈ ਭਗਵੰਤ ਮਾਨ ਜੋ ਇਸ ਦੁਨੀਆ ਦੇ ਨੇਤਾ ਹਨ ਜੋ ਵੀ ਹਨ ਉਹਨਾਂ ਨੇ ਬਹੁਤ ਹੀ ਇਹਨਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਯੋਗਦਾਨ ਉਹਨਾਂ ਨੇ ਦਿੱਤਾ ਹੈ ਉਹਨਾਂ ਦਾ ਸਾਨੂੰ ਉਹਨਾਂ 'ਤੇ ਬਹੁਤ ਹੀ ਮਾਣ ਹੈ